ਮੈਂ ਦੋਨੋਂ ਪਹਿਲੂਆਂ ਨੂੰ ਆਪਣੇ ਸਮੇਂ ਅਨੁਸਾਰ ਮੈਨੇਜ਼ ਕਰ ਲੈਦੀ ਹਾਂ ਜਦ ਮੇਰਾ ਸਕੂਲ ਦਾ ਕੰਮ ਹੋ ਜਾਂਦਾ ਹੈ ਤਾਂ ਮੈਂ ਗਾਣਾ ਗਾ ਕੇ ਆਪਣਾ ਮਨੋਰੰਜਨ ਕਰ ਲੈਂਦੀ ਹਾਂ